ਸਾਡਾ ਫੋਟੋਗ੍ਰਾਫੀ ਦਾ ਕੰਮ ਹੈ ਜੀ ਅਤੇ ਫੋਟੋਗਰਾਫੀ ਦਾ ਕੰਮ ਕਰਕੇ ਸਾਡਾ ਯਾਨੀ ਕਿ ਫੋਨ ਨਾਲ ਵੀ ਟੈਕਨੋਲੋਜੀ ਆ ਗਈ ਹੈ ਪਹਿਲਾਂ ਸਾਡਾ ਆਹ ਹੁੰਦਾ ਸੀ ਕਿ ਲੈਂਜ ਬਾਰ ਬਾਰ ਚੇਂਜ ਕਰਨੇ ਅੱਜ ਕੱਲ੍ਹ ਫੋਨ ਆ ਗਏ ਨੇ ਫੋਨ ਦੇ ਵਿੱਚ ਸਭ ਕੈਮਰੇ ਸੋਫਟਵੇਅਰ ਕਾਫੀ ਟੈਕਨੋਲਜੀ ਵਧੀਆ ਆਈ ਹੋਈ ਹੈ ਹਰੇਕ ਕੋਈ ਆਪਣੀ ਫੋਟੋ ਖਿੱਚ ਕੇ ਆਪਣੀ ਡਾਊਨਲੋਡ ਕਰਕੇ ਆਪਣੀ ਅਪਡੇਟ ਕਰ ਦਿੰਦਾ ਵੀ ਫੇਸਬੁੱਕ ਅਤੇ ਇੰਸਟਾ 'ਤੇ ਠੀਕ ਹੈ ਅਤੇ ਇੱਥੇ ਹੀ ਬਹੁਤ ਵਧੀਆ ਯਾਨੀ ਕਿ ਆਪਣਾ ਕੰਮ ਲੈ ਰਹੇ ਨੇ ਫੋਟੋਗ੍ਰਾਫੀ ਤੋਂ ਆਪਣਾ ਹਰੇਕ ਕੋਈ ਆਪਣਾ ਫੋਟੋਗ੍ਰਾਫੀ ਦਾ ਕੰਮ ਇੱਥੋਂ ਹੀ ਯਾਨੀ ਕਿ ਕਰਕੇ ਫੋਟੋ ਖਿੱਚ ਕੇ ਆਪਣੀ ਅਪਲੋਡ ਕਰ ਲੈਂਦਾ ਜਾਂ ਫੋਟੋ ਤੋਂ ਸਾਡੇ ਕੋਲ ਕਢਾ ਲੈਂਦਾ ਜੀ ਅਤੇ ਕਾਫੀ ਵਧੀਆ ਯਾਨੀ ਕਿ ਪ੍ਰੋਸੀਜਰ ਚੱਲਿਆ ਹੋਇਆ ਵਾ ਟੈਕਨੋਲਜੀ ਆ ਗਈ ਹੈ ਕਾਫੀ ਵਧੀਆ ਯਾਨੀ ਕਿ ਹੋ ਰਿਹਾ ਵਾ ਸਾਡਾ ਕੰਮ ਵੀ ਬਹੁਤ ਵਧੀਆ ਆ ਯਾਨੀ ਕਿ ਕਹਿਣ ਦਾ ਮਤਲਬ ਸੋਫਟਵੇਅਰ ਅਪਡੇਟ ਹੁੰਦੇ ਨੇ ਕੋਈ ਟੈਕਨੋਲੋਜੀ ਵਧੀਆ ਆਉਂਦੀ ਹੈ ਨਵੇਂ ਨਵੇਂ ਟੈਕਨੋਲੋਜੀ ਆ ਰਹੀ ਹੈ ਫੋਨ 'ਚ ਜਾਂ ਲੈ ਸਾਨੂੰ ਬਾਰ ਬਾਰ ਲੈਂਸ ਨਾਲੋਂ ਵਧੀਆ ਇੱਥੇ ਹੋ ਰਿਹਾ ਵਾ